ਜਦੋਂ ਮੈਂ ਕੋਲਜ ਵਿੱਚ ਪੜ੍ਹਦੀ ਸੀ ਉਦੋਂ ਸਾਡੇ ਕੋਲਜ ਵਿੱਚ ਭ ਦੌੜਾਂ ਦਾ ਕੰਪਟੀਸ਼ਨ ਹੋਇਆ ਜਿਸ ਵਿੱਚ ਕਿ ਮੈਂ ਦੋ ਸੌ ਮੀਟਰ ਦੌੜ ਵਿੱਚ ਭਾਗ ਲਿਆ ਦੌੜ ਵਿੱਚ ਭਾਗ ਲੈਣ ਤੋਂ ਪਹਿਲਾਂ ਹੀ ਮੈਂ ਉਸਦੀ ਪ੍ਰੈਕਟਿਸ ਕਰਦੀ ਰਹੀ ਜਿਸ ਵਿੱਚ ਕਿ ਮੈਂ ਸਵੇਰੇ ਵੀ ਦੋੜ੍ਹਾਂ ਲਗਾਉਣ ਜਾਂਦੀ ਸੀ ਅਤੇ ਸ਼ਾਮ ਨੂੰ ਵੀ ਦੋੜ੍ਹਾਂ ਲਗਾਉਣ ਜਾਂਦੀ ਸੀ ਅਤੇ ਮੈਂ ਆਪਣੇ ਡਾਇਟ ਵੀ ਸਹੀ ਲਈ ਜਿਵੇਂ ਕਿ ਮੈਂ ਫਲ ਫਰੂਟ ਖਾਧੇ ਔਰ ਸੈਲਡ ਵੀ ਖਾਧਾ ਹੈ ਨਾ ਅਤੇ ਬਨਾਨਾ ਸ਼ੇਕ ਅਤੇ ਹੋਰ ਵੀ ਬਹੁ ਅਤੇ ਰਾਤ ਦੀ ਸ ਰੋਟੀ ਵੀ ਮੈਂ ਛੱਡ ਦਿੱਤੀ ਸੀਗੀ ਇੱਕ ਟਾਈਮ ਦੀ ਅਤੇ ਸੈਲਡ ਅਤੇ ਸਿਰਫ ਇੱਕ ਟਾਈਮ ਰਾਤ ਨੂੰ ਮੈਂ ਸਿਰਫ ਸੈਲਡ ਹੀ ਖਾਂਦੀ ਸੀ ਅਤੇ ਮੈਂ ਵਧੀਆ ਡਾਇਟ ਲਈ ਉਸ ਤੋਂ ਬਾਅਦ ਮੈਂ ਜਦੋਂ ਪ੍ਰੈਕ ਜਦੋਂ ਕਿ ਸਾਡੇ ਕੰਪਟੀਸ਼ਨ ਹੋਇਆ ਉਸ ਵਿੱਚ ਮੈਂ ਦੌੜਨ ਲਈ ਦੂਸਰੇ ਸਥਾਨ 'ਤੇ ਆਈ ਜਿਸ ਵਿੱਚ ਕਿ ਮੈਨੂੰ ਮੈਨੂੰ ਬਹੁਤ ਜ਼ਿਆਦਾ ਵਧੀਆ ਫੀਲ ਹੋਇਆ ਅਤੇ ਮੈਂ ਇਸ ਤੋਂ ਪ੍ਰੇਰਿਤ ਹੋ ਕੇ ਇਸ ਤੋਂ ਮੈਂ ਪ੍ਰੇਰਿਤ ਹੋ ਕੇ ਅੱਗੇ ਲਈ ਵੀ ਦੌੜਾਂ ਆਪਣੀਆਂ ਜਾਰੀ ਰੱਖੀਆਂ ਅਤੇ ਮੈਂ ਦੋੜ੍ਹਾਂ ਵਿੱਚ ਭਾਗ ਲੈ ਕੇ ਸੈਕਿੰਡ ਆਉਣ 'ਤੇ ਫਿਰ ਮੈਨੂੰ ਉਸ ਤੋਂ ਮੈਡਲ ਮਿਲਿਆ ਅਤੇ ਮੈਂ ਉਸ ਤੋਂ ਹੋਰ ਵੀ ਜ਼ਿਆਦਾ ਪ੍ਰਭਾਵਿਤ ਹੋ ਕੇ ਅੱਗੇ ਤੋਂ ਵੀ ਮੈਂ ਦੌੜ੍ਹਾਂ ਆਪਣੀਆਂ ਚਾਲੂ ਹੀ ਰੱਖੀਆਂ ਹਨ